ਵੈਸੇ ਤਾਂ ਮੈਂ ਘੁੰਮਣ ਦਾ ਸ਼ੌਕੀਨ ਹਾਂ ਕਈ ਥਾਵਾਂ ਦੇ ਵਿੱਚ ਘੁੰਮਦਾ ਰਹਿੰਦਾ ਹਾਂ ਆਪਾਂ ਅੱਜ ਗੱਲ ਕਰਾਂਗੇ ਇੱਕ ਤੋ ਇੱਕ ਦੋ ਥਾਵਾਂ ਦੀ ਜਿਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕੁੱਲੂ ਮਨਾਲੀ ਜੋ ਕਿ ਕੁੱਲੂ ਮਨਾਲੀ ਦੀਆਂ ਵਾਦੀਆਂ ਆਪਣੇ ਪੰਜਾਬ ਦੇ ਵਿੱਚ ਜਦੋਂ ਗਰਮੀ ਜ਼ਿਆਦਾ ਵੱਧ ਜਾਂਦੀ ਹੈ ਚੌਥੇ ਪੰਜਵੇਂ ਮਹੀਨ ਮਨ ਮਹੀਨੇ ਦੇ ਵਿੱਚ ਅਪ੍ਰੈਲ ਜਾਂ ਮਈ ਮਹੀਨੇ ਦੇ ਵਿੱਚ ਉਸ ਟਾਈਮ ਜ਼ਿਆਦਾਤਰ ਸੈਲਾਨੀ ਕੁੱਲੂ ਮਨਾਲੀ ਜਾਂ ਠੰਡੇ ਇਲਾਕੇ ਵਿੱਚ ਜਾਂਦੇ ਹਨ ਅਤੇ ਕੁੱਲੂ ਮਨਾਲੀ ਦੇ ਵਿੱਚ ਜਦੋਂ ਆਪਾਂ ਜਾਂਦੇ ਹਾਂ ਅਤੇ ਉੱਥੇ ਦੇ ਮੌਸਮ ਉੱਥੇ ਦੀਆਂ ਵਾਦੀਆਂ ਦੇਖ ਕੇ ਉੱਥੇ ਦਾ ਸਕੂਨ ਦੇਖ ਕੇ ਬਹੁਤ ਹੀ ਦਿਲ ਨੂੰ ਸਕੂਨ ਮਿਲਦਾ ਹੈ ਅਤੇ ਦੂਜੀ ਗੱਲ ਕਰੀਏ ਆਪਾਂ ਸ਼ਿਮਲੇ ਦੀ ਸ਼ਿਮਲਾ ਜੋ ਕਿ ਬਹੁਤ ਹੀ ਟੂਰੈਸਟ ਸੈਲਾਨੀਆਂ ਦਾ ਸਥਾਨ ਹੈ ਉੱਥੇ ਦੇਸ਼ ਦੇ ਕੋ ਦੇਸ਼ ਤੋਂ ਕਈ ਥਾਵਾਂ ਤੋਂ ਬਾਹਰੋਂ ਵੀ ਇੰਟਰਨੈਸ਼ਨਲ ਤੋਂ ਵੀ ਬਹੁਤ ਹੀ ਲੋਕ ਆ ਕੇ ਉੱਥੇ ਅਨੰਦ ਮਾਣਦੇ ਹਨ ਅਤੇ ਸ਼ਿਮਲੇ ਦੇ ਵਿੱਚ ਹਨੂੰਮਾਨ ਟੈਂਪਲ ਦੀ ਆਪਾਂ ਗੱਲ ਕਰੀਏ ਉਹ ਸ਼ਿਮਲੇ ਦਾ ਸਭ ਤੋਂ ਬੜੀ ਮੂਰਤੀ ਹੈ ਉੱਥੇ ਦੀ ਉਸ ਮੂਰਤੀ ਨੂੰ ਦੇਖ ਕੇ ਵੀ ਦਿਲ ਨੂੰ ਸਕੂਨ ਮਿਲਦਾ ਹੈ